ਸਾਡੇ ਘਰ ਰਸੋਈ ਦੇ ਵਿੱਚ ਬਿਜਲੀ ਨਾਲ ਕਾਫੀ ਚਲਣ ਵਾਲੇ ਉਪਕਰਨ ਉਪਲਬਧ ਨੇ ਜਿਵੇਂ ਮਿਕਸਚਰ ਇਲੈਕਟ੍ਰੀਕ ਕੈਟਲ ਹੈ ਗੀਜ਼ਰ ਲੱਗਿਆ ਹੋਇਆ ਓਵਨ ਹੈ ਤਾਂ ਜਦੋਂ ਅਸੀਂ ਮਤਲਬ ਕੋਈ ਜੂਸ ਪੀਣਾ ਹੁੰਦਾ ਹੈਗਾ ਤਾਂ ਅਸੀਂ ਮਿਕਸਚਰ ਦੇ ਵਿੱਚ ਜੂਸ ਬਣਾ ਲੈਦੇ ਆਂਗੇ ਇਲੈਕਟ੍ਰੀਕ ਕੈਟਲ ਦੇ ਵਿੱਚ ਅਸੀਂ ਪਾਣੀ ਗਰਮ ਕਰਕੇ ਪੀ ਲੈਂਦੇ ਆਂਗੇ ਕਿਉਂਕਿ ਅੱਜ ਕੱਲ੍ਹ ਸਰਦੀਆਂ ਦੇ ਦਿਨ ਚੱਲ ਰਹੇ ਨੇ ਤਾਂ ਅਸੀਂ ਸਰਦੀਆਂ ਦੇ ਵਿੱਚ ਸਵੇਰੇ ਉੱਠ ਕੇ ਗਰਮ ਪਾਣੀ ਪੀਂਦੇ ਆਂਗੇ ਤਾਂ ਜਿਵੇਂ ਅਸੀਂ ਹੋਸਟਲ ਦੇ ਵਿੱਚ ਵੀ ਰਹਿੰਦੇ ਆਂਗੇ ਤਾਂ ਉਹਦੇ ਵਿੱਚ ਅਸੀਂ ਮੈਗੀ ਵੀ ਬਣਾ ਲੈਂਦੇ ਆਂਗੇ ਚਾਹ ਵੀ ਬਣਾ ਲੈਂਦੇ ਆਂਗੇ ਅਤੇ ਗੀਜ਼ਰ ਲੱਗਿਆ ਹੋਇਆ ਹੈਗਾ ਮਤਲਬ ਪਹਿਲਾਂ ਦੇ ਟਾਈਮ ਦੇ ਵਿੱਚ ਸਰਦੀਆਂ ਦੇ ਵਿੱਚ ਜਦੋਂ ਆਪਾਂ ਠੰਡੇ ਪਾਣੀ ਨਾਲ ਹੱਥ ਵਗੈਰਾ ਧੋਂਦੇ ਆਂਗੇ ਤਾਂ ਉਹ ਸੁੱਜ ਜਾਂਦੇ ਸੀਗੇ ਤਾਂ ਹੁਣ ਮਤਲਬ ਅਸੀਂ ਗੀਜ਼ਰ ਔਨ ਕਰ ਲੈਂਦੇ ਆਂਗੇ ਤਾਂ ਪਾਣੀ ਗਰਮ ਆਉਣ ਲੱਗ ਜਾਂਦਾ ਐਗਾ ਤਾਂ ਉਹਦੇ ਸਾਨੂੰ ਮਤਲਬ ਬਹੁਤ ਸਾਰੇ ਫਾਇਦੇ ਹੋ ਰਹੇ ਹੈਗੇ ਅਤੇ ਸਾਡੇ ਘਰ ਓਵਨ ਵੀ ਐਗਾ ਮਤਲਬ ਓਵਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਬਣਾ ਲੈਂਦੇ ਆਂਗੇ ਪਹਿਲਾਂ ਸੀਗਾ ਵੀ ਟਾਈਮ ਲੱਗਦਾ ਸੀਗਾ ਗੈਸ ਸਿਲੰਡਰ 'ਤੇ ਚੀਜ਼ਾਂ ਬਣਾਉਣ ਦੇ ਵਿੱਚ ਤਾਂ ਅੱਜ ਕੱਲ੍ਹ ਮਤਲਬ ਓਵਨ ਦੇ ਵਿੱਚ ਲਗਾਤਾਰ ਅਸੀਂ ਬਹੁਤ ਜਲਦੀ ਕੁਛ ਨਾ ਕੁਛ ਬਣਾ ਕੇ ਖਾ ਲੈਂਦੇ ਆਂਗੇ ਅਤੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ ਸੀਗੇ ਤਾਂ ਉੱਦੋਂ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਸੀਗਾ ਆਪਣੇ ਘਰ ਦੇ ਕੰਮਾਂ ਦੇ ਵਿੱਚ ਰਸੋਈ ਦੇ ਕੰਮਾਂ ਨੂੰ ਕਰਨ ਦੇ ਲਈ ਮਲ ਜਿਹੜੀਆਂ ਸਾਡੀਆਂ ਮਾਤਾਵਾਂ ਸੀਗੀਆਂ ਉਹ ਲਗਾਤਾਰ ਆਪਣਾ ਸਾਰਾ ਟਾਈਮ ਸੀ ਜਿਹੜਾ ਇਹਦੇ ਵਿੱਚ ਵੇਸਟ ਕਰ ਦਿੰਦੀਆਂ ਸੀਗੀਆਂ ਅੱਜ ਕੱਲ੍ਹ ਉਹ ਜਦੋਂ ਨਵੇਂ ਉਪਕਰਨ ਆਏ ਨੇ ਤਾਂ ਉਹ ਆਪਣਾ ਟਾਈਮ ਵੀ ਆ ਜਿਹੜਾ ਬਹੁਤ ਚੰਗੇ ਤਰੀਕੇ ਨਾਲ ਜੁਟੀਲਾਈਜ਼ ਕਰ ਰਹੇ ਨੇ